ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਅ ਮੈਂ ਕਿਹਾ ਆਪਾਂ ਹੋ ਗਏ ਇੱਧਰੋਂ ਦਰਬਾਰ ਸਾਹਿਬ ਤੋਂ ਬਸ ਫ੍ਰੀ ਹੋ ਹੀ ਚੱਲੇ ਹਾਂ ਬਸ ਪੰਜ ਸੱਤ ਮਿੰਟ ਤੱਕ ਅਤੇ ਹੁਣ ਅਗਲਾ ਫਿਰ ਉਸ ਤੋਂ ਬਾਅਦ ਅੱਗੇ ਕੀ ਪਲੈਨ ਵਾ ਕਿੱਧਰ ਨੂੰ ਅਸੀਂ ਜਾਈਏ ਅੱਗੇ ਫਿਰ ਦੱਸ ਦਿਉ ਮਾੜਾ ਜਿਹਾ ਗਾਈਡ ਕਰ ਦਿਉ ਕਿ ਕਿੱਧਰ ਨੂੰ ਘੁੰਮ ਕੇ ਆਈਏ ਮਾੜਾ ਜਿਹਾ ਅੱਛਾ ਜੀ ਉਹ ਲਾਗੇ ਹੀ ਆ ਆਪਣੇ ਇੱਥੋਂ ਵਾਹਗਾ ਬਾਡਰ ਦਰਬਾਰ ਸਾਹਿਬ ਤੋਂ ਕਿੱਦਾਂ ਠੀਕ ਹੈ ਜੀ ਠੀਕ ਹੈ ਅਤੇ ਕਿੰਨੇ ਕੁ ਵਜੇ ਨਾਲ ਚੱਲੀਏ ਫਿਰ ਆਪਾਂ ਇੱਥੋਂ ਅਤੇ ਕਿੰਨੇ ਕੁ ਵਜੇ ਤੱਕ ਪਹੁੰਚ ਜਾਂਗੇ ਅਤੇ ਕੀ ਹਿਸਾਬ ਕਿਤਾਬ ਆ ਠੀਕ ਆ ਜੀ ਠੀਕ ਆ ਅਤੇ ਆਪਾਂ ਉੱਥੇ ਰਸਤੇ 'ਚ ਕਿੰਨਾ ਕੁ ਟਾਈਮ ਲੱਗਣਾ ਵਾ ਦਸ ਪੰਦਰਾਂ ਮਿੰਟ 'ਚ ਪਹੁੰਚ ਜਾਂਦਾ ਬੰਦਾ ਜਾਂ ਹੈਗਾ ਟਾਈਮ ਲੱਗਣਾ ਉੱਥੇ ਥੋੜ੍ਹਾ ਜਿਹਾ ਅੱਛਾ ਜੀ ਠੀਕ ਆ ਅਤੇ ਉਹਤਾਂ ਉਹ ਆਪਾਂ ਤਾਂ ਹਜੇ ਮਤਲਬ ਕਿ ਹਜੇ ਤਾਂ ਬਾਰਾਂ ਕੁ ਹੀ ਵੱਜੇ ਆ ਅਤੇ ਫਿਰ ਉਹ ਵਿੱਚ ਕੀ ਕਰੀਏ ਵਿੱਚ ਟਾਈਮ ਤਾਂ ਹੈ ਅਤੇ ਜਗ੍ਹਾ ਹੋਰ ਕਿਤੇ ਕਿਤੇ ਲਾਗੇ ਸ਼ਾਗੇ ਅੱਛਾ ਜੀ ਠੀਕ ਹੈ ਹਾਂਜੀ ਹਾਂਜੀ ਉਹ ਉਹਦੇ ਬਾਰੇ ਵੀ ਸੁਣਿਆ ਹਾਂਜੀ ਉਹ ਤੁਸੀਂ ਦੱਸ ਦਿਓ ਆਹੋ ਹਜੇ ਬਾਰਾਂ ਸਾਢੇ ਬਾਰਾਂ ਹੋਏ ਆ ਅਤੇ ਆਪਾਂ ਠੀਕ ਆ ਜੀ ਠੀਕ ਆ ਕੋਈ ਨਹੀਂ ਆਪਾਂ ਫਿਰ ਮੈਂ ਬਸ ਬਸ ਇੱਧਰੋਂ ਫਰੀ ਹੋ ਕੇ ਅਤੇ ਫਿਰ ਤੁਹਾਨੂੰ ਫੋਨ ਕਰਦਾ ਅਤੇ ਫਿਰ ਆਪਾਂ ਅੱਗੇ ਉੱਧਰ ਪਲੈਨ ਜਿਹੜਾ ਉੱਧਰ ਚੱਲਦੇ ਹਾਂ ਫਿਰ ਆਪਾਂ ਠੀਕ ਆ ਜੀ ਹਾਂਜੀ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਠੀਕ ਠੀਕ ਠੀਕ